ਸ਼ਹਿਰਾਂ ਵਿੱਚ ਰਹਿਣ ਦੀ ਸਥਿਤੀ ਨੂੰ ਬੈਟਰ ਬਣਾਉਣ ਲਈ ਗਲੀ ਮੁਹੱਲੇ ਵਿੱਚ ਸਭ ਤੋਂ ਜ਼ਰੂਰੀ ਇਹ ਹੈ ਕਿ ਏ ਸਫਾਈ ਇਹ ਯੋਜਨਾ ਲਾਗੂ ਕੀਤੀ ਗਈ ਹੈ ਜੇਕਰ ਅਸੀਂ ਆਪਣੀ ਗਲੀ ਮੁਹੱਲੇ ਵਿੱਚ ਸਾਫ ਸਫਾਈ ਰੱਖਾਂਗੇ ਤਾਂ ਸਾਨੂੰ ਰਹਿਣ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ ਸਫਾਈ ਵੱਧ ਤੋਂ ਵੱਧ ਹੋਵੇਗੀ ਜੇਕਰ ਉੱਥੇ ਗੰਦਗੀ ਹੋਵੇਗੀ ਤਾਂ ਸਾਡੇ ਤੋਂ ਰਿਹਾ ਵੀ ਨਹੀਂ ਜਾਣਾ ਕਿਸੇ ਤੋਂ ਵੀ ਨਹੀਂ ਇਸ ਲਈ ਨਵੀਆਂ ਯੋਜਨਾਵਾਂ ਇਹ ਹਨ ਕਿ ਸੀਵਰੇਜ ਨੂੰ ਸਾਫ ਕੀਤਾ ਜਾਵੇ ਝਾੜੂ ਪੋਚਾ ਕੀਤਾ ਜਾਵੇ ਚੰਗੀ ਤਰ੍ਹਾਂ ਘਰਾਂ ਵਿੱਚ ਬਾਹਰ ਗਲੀਆਂ ਸਾਫ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ ਕਿਤੇ ਵੀ ਤਰ੍ਹਾਂ ਕੋਈ ਵੀ ਗੰਦਗੀ ਜਾਂ ਸਿਗਰੇਟ ਸਿੱਟਣ ਦੀ ਮਨਾਹੀ ਹੋਵੇ ਇਹ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ ਅਤੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਲਈ ਸਭ ਤੋਂ ਜ਼ਰੂਰੀ ਤਾਂ ਇਹ ਹੈ ਕਿ ਜੋ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਉਹ ਸਰਕਾਰ ਨੇ ਬੰਦ ਕੀਤੀ ਹੋਈ ਹੈ ਵੀ ਜੇਕਰ ਪਰਾਲੀ ਨੂੰ ਅੱਗ ਨਾ ਲੱਗੇਗੀ ਤਾਂ ਨਾ ਹੀ ਧੂਆਂ ਜਹਿਰੀਲਾ ਹੋਵੇਗਾ ਜਿਸ ਨਾਲ ਵੀ ਸਾਂਝ ਆਉਣ ਵਾਲੇ ਮੁਸ਼ਕਿਲਾਂ ਘੱਟ ਹੋਣਗੀਆਂ ਜਿਹਦੇ ਨਾਲ ਬਿਮਾਰੀਆਂ ਵੀ ਘੱਟ ਲੱਗਣਗੀਆਂ ਅਤੇ ਟ੍ਰੈਫਿਕ ਨਿਯਮਾਂ ਵਿੱਚ ਵੀ ਕਾਫੀ ਕਦਮ ਚੁੱਕੇ ਗਏ ਹਨ ਜੇਕਰ ਟਰੈਫਿਕ ਘਟੇਗਾ ਤਾਂ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਘਟੇਗਾ ਇਸ ਲਈ ਸਰਕਾਰ ਨੇ ਕਾਫੀ ਨਵੇਂ ਕਾਨੂੰਨ ਲਾਗੂ ਕੀਤੇ ਹਨ